ਹਾਂਜੀ ਮੈਂ ਤਸਵੀਰ ਲੈਣ ਲਈ ਕਈ ਸਾਰੀਆਂ ਯਾਤਰਾ ਕੀਤੀਆਂ ਹਨ ਜਿਵੇਂ ਕਿ ਰਾਜਸਥਾਨ ਪੂਨੇ ਗੋਆ ਸ਼ਿਮਲਾ ਕਸੌਲੀ ਅਤੇ ਹੋਰ ਵੀ ਕਈ ਥਾਵਾਂ ਅਤੇ ਗਿਆ ਹਾਂ ਉੱਥੇ ਪਿਚਰ ਲੈਣ ਦਾ ਅਲੱਗ ਹੀ ਆਨੰਦ ਆਉਂਦਾ ਹੈ ਜਿਵੇਂ ਕਿ ਰਾਜਸਥਾਨ ਵਿੱਚ ਉੱਥੇ ਪੁਰਾਣੇ ਪੁਰਾਣੇ ਕਿਲ੍ਹੇ ਹ ਹੁੰਦੇ ਹਨ ਅਤੇ ਸੈਮ ਵਿੱਚ ਰੇਤੀਲੇ ਪਹਾੜ ਹੁੰਦੇ ਹਨ ਉੱਥੇ ਮੱਲੋ ਮੱਲੀ ਹੀ ਫੋਟੋ ਖਿੱਚਣ ਦਾ ਜੀਅ ਕਰਦਾ ਅਤੇ ਫੋਟੋ ਵੀ ਹੀ ਆਉਂਦੀ ਹੈ ਸ਼ਿਮਲੇ ਕਸੌਲ ਵਿੱਚ ਪਹਾੜਾਂ 'ਤੇ ਬਰਫ ਪਈ ਹੁੰਦੀ ਆ ਅਤੇ ਬਰਫ ਵਿੱਚ ਖੇਡਣ ਦਾ ਮਜ਼ਾ ਆਉਂਦਾ ਹੈ ਅਤੇ ਪਹਾੜਾਂ ਵਿੱਚ ਫੋਟੋਆਂ ਖਿਚਾਉਣ ਦਾ ਵੀ ਅਲੱਗ ਹੀ ਮਜ਼ਾ ਹੁੰਦਾ ਹੈ ਪਰ ਹੁਣ ਮੇਰੀ ਇੱਛਾ ਲੇਹ ਲਦਾਖ ਅਤੇ ਕਸ਼ਮੀਰ ਜਾਣ ਦੀ ਹੈ ਉੱਥੇ ਜਾ ਕੇ ਫੋਟੋਆਂ ਖਿੱਚਣ ਦੀ ਬਹੁਤ ਇੱਛਾ ਹੈ ਕਿਉਂਕਿ ਉੱਥੋਂ ਦੇ ਪਹਾੜ ਅਤੇ ਬਰਫ ਦਾ ਮਜ਼ਾ ਹੋਰ ਹੀ ਲੈਵਲ 'ਤੇ ਹੁੰਦਾ ਹੈ ਉੱਥੋਂ ਦੀ ਬਰਫ ਬਹੁਤ ਠੰਢੀ ਹੁੰਦੀ ਹੈ ਅਤੇ ਉੱਥੇ ਫੋਟੋਆਂ ਅਤੇ ਵੀਡੂਆਂ ਵੀ ਬਹੁਤ ਸਾਰੀਆਂ ਬਣਾਈਆਂ ਜਾ ਸਕਦੀਆਂ ਹਨ